ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਮੈਂ ਛੋਟੇ ਹੁੰਦੇ ਨੇ ਹੀ ਚੀਜ਼ਾਂ ਨੂੰ ਦੇਖ ਦੇਖ ਕੇ ਡਰਾਇੰਗ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਮੇਰੀ ਭੈਣ ਵੀ ਡਰਾਇੰਗ ਟੀਚਰ ਹੈ ਮੇਰੀਆਂ ਡਰਾਇੰਗ ਵਿੱਚ ਯਥਾਰਥਵਾਦ ਬਹੁਤ ਮਹੱਤਵਪੂਰਨ ਹੈ ਮੈਨੂੰ ਯਾਦ ਹੈ ਜਦ ਮੈਂ ਟੈਂਨਥ ਕਲਾਸ ਵਿੱਚ ਸੀ ਤਾਂ ਮੈਂ ਡਰਾਇੰਗ ਕੋਂਪਟੀਸ਼ਨ ਵਿੱਚ ਭਾਗ ਲਿਆ ਸੀ ਤੇ ਮੈਂ ਹਮੇਸ਼ਾ ਆਪਣੀ ਪੇਂਟਿੰਗ ਵਿੱਚ ਆਪਣੀਆਂ ਫੀਲਿੰਗਸ ਨੂੰ ਸ਼ੋ ਕਰਦਾ ਸੀ ਹਰ ਕੋਈ ਇਹਨਾਂ ਨੂੰ ਨਹੀਂ ਸਮਝ ਪਾਉਂਦਾ ਸੀ ਕਿਸੇ ਨੂੰ ਇਹ ਸਿਰਫ ਸਧਾਰਨ ਪੇਂਟਿੰਗ ਹੀ ਲੱਗਦੀ ਸੀ ਕਿਸੇ ਨੂੰ ਕੋਂਪਲੀਕੇਟਡ ਲੱਗਦੀ ਸੀ ਤਾਂ ਕੋਈ ਕੋਈ ਸਮਝ ਵੀ ਲੈਂਦਾ ਸੀ ਤੇ ਕੋਈ ਇਸ ਨੂੰ ਸਿਰਫ ਸਧਾਰਨ ਪੇਂਟਿੰਗ ਹੀ ਸਮਝਦਾ ਸੀ ਪਰ ਜਿਹੜੇ ਮੇਰੇ ਫਰੈਂਡਸ ਮੇਰੇ ਨਾਲ ਪੜਦੇ ਸੀ ਜਿਨਾਂ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਸੀ ਉਹ ਮੇਰੀ ਪੇਂਟਿੰਗ ਨੂੰ ਸਮਝ ਲੈਂਦੇ ਸੀ ਇਸ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ ਹਨ ਤੇ ਮੈਂ ਕਿਹੜੀ ਫੀਲਿੰਗਸ ਕਰਕੇ ਬਣਾਈ ਹੈ